ਮੈਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਂ ਆਪਣੀ ਪਹਿਲੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ ਉਸ ਟਾਈਮ ਪੰਜਵੀਂ ਅੱਠਵੀਂ ਅਤੇ ਦਸਵੀਂ ਕਲਾਸ ਬੋਰਡ ਦੀ ਹੁੰਦੀ ਸੀ ਅਤੇ ਇਹਨਾਂ ਸਾਰੀਆਂ ਕਲਾਸਾਂ ਵਿੱਚੋਂ ਹੀ ਮੈਂ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਈ ਅਤੇ ਸਾਰੀਆਂ ਕਲਾਸਾਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ ਉਸ ਤੋਂ ਬਾਅਦ ਬਾਰ੍ਹਵੀਂ ਦੀ ਪੜ੍ਹਾਈ ਨਵਾਂਸ਼ਹਿਰ ਤੋਂ ਆਰਟਸ ਦੇ ਨਾਲ ਪਾਸ ਕੀਤੀ ਅਤੇ ਉਸ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਬਠਿੰਡਾ ਤੋਂ ਕੀਤੀ ਅਤੇ ਉਸ ਤੋਂ ਬਾਅਦ ਮੈਂ ਪੀ ਜੀ ਡੀ ਸੀ ਏ ਔਰ ਐੱਮ ਐੱਸ ਈ ਆਈ ਟੀ ਪੋਸਟ ਗ੍ਰੈਜੂਏਸ਼ਨ ਵੀ ਬਠਿੰਡਾ ਤੋਂ ਹੀ ਕੀਤੀ ਉਸ ਤੋਂ ਬਾਅਦ ਮੈਂ ਸਰਕਾਰੀ ਨੌਕਰੀ ਲਈ ਟੈਸਟਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਜੋ ਜਿਸ ਵਿੱਚ ਮੈਨੂੰ ਬਹੁਤ ਲੰਬਾ ਸਮਾਂ ਲੱਗਿਆ ਕਿਉਂਕਿ ਉਸ ਟਾਈਮ 'ਤੇ ਸਰਕਾਰਾਂ ਇਸ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀਆਂ ਸਨ ਮੈਂ ਲਗਭਗ ਪੰਜ ਛੇ ਸਾਲ ਬਹੁਤ ਸਖਤ ਮਿਹਨਤ ਕੀਤੀ ਅਤੇ ਕਾਫੀ ਸਾਰੇ ਸਰਕਾਰੀ ਪੇਪਰ ਦਿੱਤੇ ਜਿਨ੍ਹਾਂ ਵਿੱਚ ਮੈਨੂੰ ਕੋਈ ਖਾਸ ਸਫਲਤਾ ਹਾਸਲ ਨਹੀਂ ਹੋਈ ਅਤੇ ਫਿਰ ਅਚਾਨਕ ਇੱਕ ਸਰਕਾਰੀ ਨੌਕਰੀ ਲਈ ਪਟਵਾਰੀ ਦੀ ਭਰਤੀ ਆਈ ਅਤੇ ਉਸ ਟਾਈਮ 'ਤੇ ਬਹੁਤ ਸਾਰਾ ਯੂਥ ਸਟਰਗਲ ਕਰ ਰਿਹਾ ਸੀ ਜਿਹਨਾਂ ਵਿੱਚੋਂ ਮੈਂ ਵੀ ਇੱਕ ਸੀ ਅਤੇ ਇਸ ਭਰਤੀ ਦੇ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਇਸ ਲਈ ਮੈਂ ਤਿੰਨ ਚਾਰ ਮਹੀਨੇ ਬਹੁਤ ਸਖਤ ਮਿਹਨਤ ਕੀਤੀ ਅਤੇ ਲਗਾਤਾਰ ਦੋ ਪੇਪਰ ਪ੍ਰੀ ਅਤੇ ਮੇਨਜ਼ ਪਾਸ ਕੀਤੇ ਅਤੇ ਫਾਈਨਲੀ ਆਪਣੀ ਪਟਵਾਰੀ ਦੀ ਪੋਸਟ ਲਈ ਸਲੈਕਟ ਹੋ ਗਈ ਜਿਸ ਕਰਕੇ ਅੱਜ ਮੈਂ ਬਹੁਤ ਖੁਸ਼ ਹਾਂ